ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਸ੍ਰੀ ਦਰਬਾਰ ਸਾਹਿਬ ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਹੈ ਅੰਮ੍ਰਿਤ ਸ਼ਹਿਰ ਅੰਮ੍ਰਿਤਸਰ ਸ਼ਹਿਰ ਮਾਝੇ ਵਿੱਚ ਆਉਂਦਾ ਹੈ ਇਹ ਸਿੱਖਾਂ ਦਾ ਸਭ ਤੋਂ ਧਾ ਪਵਿੱਤਰ ਧਾਰਮਿਕ ਸਥਾਨ ਮੰਨਿਆ ਜਾਂਦਾ ਹੈ ਇਸ ਦੇ ਨੀਹ ਦਸੰਬਰ ਪੰਦਰਾਂ ਸੌ ਇਕਿਆਸੀ ਦੇ ਵਿੱਚ ਰੱਖੀ ਗਈ ਸੀ ਤੇ

ਇਹ ਗੁਰਦੁਆਰਾ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ ਪੰਦਰਾਂ ਸੌ ਸਤੱਤਰ ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਇਸਦੀ ਨੀਂਹ ਅਠਾਈ ਦਸੰਬਰ ਪੰਦਰਾਂ ਸੌ ਅਠਾਸੀ ਵਿੱਚ ਸਾਈ ਮੀਆਂ ਮੀਰ ਜੀ ਨੇ ਰੱਖੀ ਸੀ ਸੌਲਾਂ ਸੌ ਚਾਰ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ਿਤ ਕੀਤਾ ਸੀ ਇਸ ਸਥਾਨ ਨੂੰ ਅੱਠ ਸੱਠ ਤੀਰਥ ਕਿਹਾ ਜਾਂਦਾ ਹੈ ਦੋ ਸਾਲਾਂ ਬਾਅਦ ਭਾਵ ਸੌਲਾਂ ਸੌ ਛੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉਸਾਰੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਜੀ ਨੇ ਕਰਵਾਈ ਸੀ ਸਤਾਰਾਂ ਸੌ ਸਤਵੰਜਾ ਈਸਵੀ ਸਤਾਰਾਂ ਸੌ ਬਾਹਠ ਸਤਾਰਾਂ ਸੌ ਚੌਹਟ ਵਿੱਚ ਅਫਗਾਨ ਹਮਲਿਆਂ ਦੇ ਦੌਰਾਨ ਹਰਮਿੰਦਰ ਸੈਰ ਦੀ ਇਮਾਰਤ ਨਸ਼ਟ ਹੋ ਗਈ ਸੀ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੇ ਜਾਣ ਖਾਣ ਵਾਲੇ ਨੇ ਦਰਬਾਰ ਸਾਹਿਬ ਦੀ ਰਾਖੀ ਕਰਦਿਆਂ ਹੋਇਆਂ ਅੱਜ ਬਾਬਾ ਜੀ ਦੀ ਯਾਦ ਵਿੱਚ ਪਰਿਕਰਮਾ ਵਿੱਚ ਸ਼ਹੀਦੀ ਬੁੰਗਾ ਸਥਿਤ ਹੈ ਜਿੱਥੇ ਲੜੀਵਾਰ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਏ ਜਾਂਦੇ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮੌਜੂਦਾ ਰੂਪ ਚੋਹਟ ਵਿੱਚ ਸੁਲਤਾਨ ਉਲ ਕੌਮ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿੱਚ ਆਇਆ